ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾਮ ਕਾਰਤਿਕ ਹੈ ਮੈਂ ਸਰ ਪਠਾਨਕੋਟ ਤੋਂ ਬੋਲ ਰਿਹਾ ਹੈਗਾ ਮੈਨੂੰ ਸਰ ਤੁਹਾਡਾ ਨੰਬਰ ਮੈਂ ਗਰਾਊਂਡ 'ਚ ਗਿਆ ਸੀ ਅਤੇ ਉੱਥੇ ਮੇਰੇ ਇੱਕ ਫਰੈਂਡ ਨੇ ਦਿੱਤਾ ਸੀ ਅਤੇ ਉਹਨੇ ਦੱਸਿਆ ਸੀ ਤੁਹਾਡੇ ਰੈਸਟੋਰੈਂਟ ਬਾਰੇ ਕਹਿੰਦਾ ਬੋਲਦਾ ਸੀ ਕਿ ਤੁਹਾਡੇ ਰੈਸਟੋਰੈਂਟ 'ਚ ਬਹੁਤ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਹੈਗੀਆਂ ਉੱਥੇ ਹਰ ਅਤੇ ਉੱਥੇ ਫਾਸਟ ਫੂਡ ਕਈ ਤਰ੍ਹਾਂ ਦਾ ਮਿਲਦਾ ਔਰ ਹੁੰਦਾ ਵੀ ਕਾਫੀ ਟੇਸਟੀ ਹੈਗਾ ਇਸ ਕਰਕੇ ਸਰ ਮੈਂ ਸੋਚ ਰਿਹਾ ਸੀ ਕਿ ਮੇਰਾ ਬ੍ਰਦਰ ਵੀ ਥੋੜ੍ਹੇ ਦਿਨ ਤੱਕ ਘਰ ਅ ਅੱਜ ਘਰ ਆ ਜਾਣਾ ਉਹਨੇ ਅਤੇ ਉਹਨੂੰ ਵਾਈਟ ਸੋਸ ਪਾਸਤਾ ਬਹੁਤ ਪਸੰਦ ਹੈਗਾ ਇਸ ਕਰਕੇ ਮੈਂ ਉਹਦੇ ਲਈ ਉਹ ਔਡਰ ਕਰਨਾ ਸੀ ਵਾਈਟ ਸੋਸ ਪਾਸਤਾ ਅਤੇ ਤੁਸੀਂ ਉਹਦੇ ਵਿੱਚ ਸਰ ਐਕਸਟਰਾ ਚੀਜ਼ ਪਾ ਦਿਓ ਔਰ ਉਸ ਦੀ ਡਿਲੀਵਰੀ ਸਰ ਸ਼ਾਮ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਕਰ ਦਿਓ ਕਿਉਂਕਿ ਉਹਨੇ ਵੀ ਸ਼ਾਮ ਨੂੰ ਪੰਜ ਪੰਜ ਵਜੇ ਤੱਕ ਆ ਹੀ ਜਾਣਾ ਸ਼ਾਇਦ ਔਰ ਥੋੜ੍ਹਾ ਮਤਲਬ ਕਿ ਮਿਰਚੀ ਤੇਜ਼ ਨਾ ਹੋਏ ਟੇਸਟੀ ਹੋਏ ਥੋੜ੍ਹਾ ਬਹੁਤਾ ਉਹਨੂੰ ਖਾਣ 'ਚ ਵੀ ਮਤਲਬ ਅੱਛਾ ਲੱਗੇ ਇਸ ਕਰਕੇ ਸਰ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਔਰ ਆਪਣੀ ਫੀਸ ਦੱਸ ਦਿਓ ਸਰ ਆਪਾਂ ਔਨਲਾਈਨ ਪੇ ਕਰ ਦਾਂਗੇ ਥੈਂਕ ਯੂ